ਹੈਲੋ ਹਾਂਜੀ ਸਰ ਨਮਸਕਾਰ ਜੀ ਹਾਂ ਸਰ ਕਿਹੜੇ ਬੁੱਕ ਸਟੋਰ ਤੋਂ ਬੋਲ ਰਹੇ ਹੋ ਜੀ ਠੀਕ ਹੈ ਸਰ ਫਿਰ ਤਾਂ ਹਾਂ ਸਟੇਸ਼ਨਰੀ ਹਾਂ ਸਰ ਆਪਾਂ ਸਟੇਸ਼ਨਰੀ ਬਾਰੇ ਬਾਰੇ ਪੁੱਛਣਾ ਸੀ ਸਟੇਸ਼ਨਰੀ ਚਾਹੀਦੀ ਸਾਨੂੰ ਨਾ ਕੁਝ ਚੀਜ਼ਾਂ ਚਾਹੀਦੀਆਂ ਸੀ ਸਾਨੂੰ ਸਰ ਸਟੇਸ਼ਨਰੀ ਤੁਸੀਂ ਵੰਨ ਬਾਏ ਵੰਨ ਕਰਕੇ ਮੈਨੂੰ ਰੇਟ ਦੱਸ ਦਿਉ ਜਿੱਦਾਂ ਸਕੈੱਚ ਹੋ ਗਏ ਹੈ ਨਾ ਰਿੰਮ ਹੋ ਗਿਆ ਇੱਦਾਂ ਹੈ ਨਾ ਅਤੇ ਠੀਕ ਹੈ ਸਰ ਠੀਕ ਹੈ ਜੀ ਠੀਕ ਠੀਕ ਠੀਕ ਠੀਕ ਹਾਂਜੀ ਹਾਂਜੀ ਠੀਕ ਹੈ ਸਰ ਜਿਹੜੀ ਕੌਪੀ ਜਿਹੜੀ ਹੈ ਉਹ ਕਿੱਦਾਂ ਦਰਜਨ ਦੇਈ ਦੀ ਹੈ ਕੌਪੀ ਕਿੱਦਾਂ ਦਰਜਨ ਹ ਹਾਂਜੀ ਹਾਂਜੀ ਹਾਂਜੀ

ਠੀਕ ਹੈ ਸਰ ਠੀਕ ਹੈ ਹਾਂ ਚਲੋ ਸਰ ਮੈਂ ਵਿਜਿਟ ਕਰਦਾ ਅਮਰਿੰਦਰ ਕੁਮਾਰ ਬੋਲ ਰਿਹਾ ਜੀ ਮੈਂ ਵਿਜਿਟ ਕਰਦਾ ਤੁਹਾਡੀ ਦੁਕਾਨ 'ਤੇ ਠੀਕ ਹੈ ਠੀਕ ਹੈ ਸਰ ਥੈਂਕ ਯੂ ਜੀ ਮਿਹਰਬਾਨੀ ਧ